ਤੈਰਾਕੀ ਮੇਰੀ ਮਨ ਪਸੰਦ ਹੈ ਬਹੁਤ ਮਨ ਪਸੰਦ ਹੈ ਪਰ ਮੈਨੂੰ ਇਹ ਪੂਲ ਵਿੱਚ ਹੀ ਕਰਨੀ ਪਸੰਦ ਹੈ ਕਿਉਂਕਿ ਪੂਲ ਦੇ ਵਿੱਚ ਇੱਕ ਤਾਂ ਤੁਹਾਨੂੰ ਨਾਲ ਗਾਈਡ ਹੁੰਦਾ ਹੈ ਅਤੇ ਸੇਫ ਰਹਿੰਦੇ ਹੋ ਤੁਸੀਂ ਮੰਨ ਲਓ ਕੋਈ ਕਿਤੇ ਕੁਛ ਮਿਸਹੈਪਨਿੰਗ ਹੁੰਦੀ ਹੈ ਜਾਂ ਕੁਛ ਵੀ ਹੈ ਤਾਂ ਜਿਹੜੇ ਉੱਥੇ ਗਾਈਡ ਹੁੰਦੇ ਨਾਲ ਉਹ ਸਾਨੂੰ ਜਾਂ ਜੇ ਬੱਚੇ ਜਿਵੇਂ ਸਿੱਖਦੇ ਹਾਂ ਉੱਥੇ ਤਾਂ ਉਹ ਬਚਾ ਸਕਦੇ ਉਹਨਾਂ ਨੂੰ ਅਤੇ ਦੂਜੀ ਗੱਲ ਅਸੀਂ ਕਿਸੇ ਮਾਹਰ ਦੀ ਨਜ਼ਰ ਦੇ ਵਿੱਚ ਅਸੀਂ ਤੈਰਾਕੀ ਕਰਦੇ ਹਾਂਆਂ ਇਹ ਫਾਇਦਾ ਇੱਕ ਹੈ ਨਾ ਅਤੇ ਦੂਸਰਾ ਪ ਮ ਹੈਗਾ ਕਿ ਪੂਲ ਦੇ ਵਿੱਚ ਪਾਣੀ ਓਨਾ ਕੁ ਹੁੰਦਾ ਕਿ ਜਿਹਦੇ ਵਿੱਚ ਮਤਲਬ ਡੁੱਬਣ ਦਾ ਖਤਰਾ ਘੱਟ ਹੁੰਦਾ ਹੈ ਸੋ ਇਹ ਸੇਫ ਹੈ ਹੈ ਨਾ ਸਾਡੇ ਆਸੇ ਪਾਸੇ ਨਦੀਆਂ ਹੈਗੀਆਂ ਜਾਂ ਹੋਰ ਦਰਿਆ ਵੀ ਨੇੜੇ ਪੈਂਦਾ ਆ ਪਰ ਅਸੀਂ ਉੱਥੇ ਤੈਰਾਕੀ ਨਹੀਂ ਕਰਦੇ ਕਿਉਂਕਿ ਉੱਥੇ ਤੈਰਾਕੀ ਕਰਨਾ ਸਾਨੂੰ ਮੈਨੂੰ ਖਤਰਨਾਕ ਲੱਗਦਾ ਹੈ ਸੋ ਮੈਂ ਪੂਲ ਵਿੱਚ ਹੀ ਤੈਰਾਕੀ ਨੂੰ ਸੇਫ ਸਮਝਦੀ ਹਾਂ